ਪੰਜਾਬੀ ਭਾਸ਼ਾ ਦੁਨੀਆਂ ਦੀ ਸਭ ਭਾਸ਼ਾਵਾਂ ਵਿੱਚੋਂ ਮਿੱਠੀ ਭਾਸ਼ਾ ਲੱਗਦੀ ਹੈ ਮੈਨੂੰ ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਅਜਿਹੇ ਹਨ ਜਿਹੜੇ ਬੜੇ ਪਿਆਰ ਨਾਲ਼ ਪਿਆਰ ਦਾ ਪ੍ਰਗਟਾਵਾ ਕਰਨ ਵਿੱਚ ਬੜੇ ਸਕਸ਼ਮ ਹਨ ਬੜੇ ਸਮਰੱਥ ਹਨ ਮੈਨੂੰ ਮੇਰੀ ਭਾਸ਼ਾ ਮੈਨੂੰ ਆਪਣੀ ਭਾਸ਼ਾ ਬਾਕੀ ਭਾਸ਼ਾਵਾਂ ਨਾਲੋਂ ਸੱਚੀ ਵਿਲੱਖਣ ਲੱਗਦੀ ਹੈ ਅਤੇ ਇਹਦੀਆਂ ਅਨੇਕਾਂ ਅਜਿਹੀਆਂ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਮੇਰੀ ਭਾਸ਼ਾ ਨੂੰ ਗੁਰੂਆਂ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ ਇਹਦੀ ਲਿਪੀ ਵੀ ਗੁਰਮੁਖੀ ਹੈ ਇਹਨਾਂ ਨੂੰ ਗੁਰੂ ਦੇ ਮੁੱਖ ਤੋਂ ਨਿਕਲੀ ਗਈ ਭਾਸ਼ਾ ਵੀ ਕਿਹਾ ਜਾਂਦਾ ਹੈ ਮੇਰੀ ਪੰਜਾਬੀ ਨੂੰ ਅੱਜ ਸਮਾਜ ਅੱਜ ਦੇ ਹਰੇਕ ਦੇਸ਼ ਵਿੱਚ ਮਾਣ ਪ੍ਰਾਪਤ ਹੈ ਮੇਰੇ ਪੰਜਾਬ ਦੇ ਲੋਕ ਦੇਸ਼ ਦੇ ਦੇਸ਼ਾਂ ਵਿਦੇਸ਼ਾਂ ਦੇ ਵੱਖ ਵੱਖ ਕੋਨਿਆਂ ਵਿੱਚ ਫੈਲੇ ਹੋਏ ਹਨ ਜਿਨ੍ਹਾਂ ਦੇ ਰਾਹੀਂ ਮੇਰੀ ਪੰਜਾਬੀ ਭਾਸ਼ਾ ਉਹਨਾਂ ਦਾ ਦੇਸ਼ਾਂ ਦਾ ਉਹਨਾਂ ਦੇਸ਼ਾਂ ਦਾ ਵੀ ਹਿੱਸਾ ਬਣੀ ਹੋਈ ਹੈ ਜਿਵੇਂ ਕਿ ਅੱਜ ਕੱਲ੍ਹ ਕਨੇਡਾ ਆਸਟ੍ਰੇਲੀਆ ਅਮਰੀਕਾ ਵਰਗੇ ਦੇਸ਼ਾਂ ਵਿੱਚ ਅਨੇਕਾਂ ਪੰਜਾਬੀ ਹਨ ਅਤੇ ਮੈਨੂੰ ਆਪਣੀ ਭਾਸ਼ਾ ਬਹੁਤ ਦਿਲਚਸਪ ਲੱਗਦੀ ਹੈ ਇਹਦਾ ਸ਼ਬਦ ਭੰਡਾਰ ਬੜਾ ਵਿਕਸਿਤ ਹੈ ਬੜਾ ਵਿਸ਼ਾਲ ਹੈ ਅਤੇ ਇਹ ਮੇਰੀ ਫੇਵਰੇਟ ਭਾਸ਼ਾ ਹੈ ਮੇਰੀ ਪਰ ਮਨਪਸੰਦ ਭਾਸ਼ਾ ਹੈ ਧੰਨਵਾਦ